ਆਵਾਜਾਈ ਦੇ ਸੰਬੰਧਿਤ ਆਪਾਂ ਕਾਫੀ ਸਾਰੀਆਂ ਚੁਣੌਤੀਆਂ ਫੇਸ ਕਰਦੇ ਹਾਂ ਜਿਵੇਂ ਕਿ ਆਪਾਂ ਜਿਹੜਾ ਰੋਜ਼ ਵਰਤੋਂ ਦੇ ਵਿੱਚ ਕਾਫੀ ਸਾਰੇ ਲੋਕ ਹੈ ਜਿਹੜੇ ਉਹ ਬੱਸ ਦੀ ਵਰਤੋਂ ਕਰਦੇ ਆ ਇੱਕ ਥਾਂ ਤੋਂ ਦੂਜੀ ਥਾਂ ਦੇ ਵਿੱਚ ਜਾਣ ਦੇ ਲਈ ਬਟ ਜਦੋਂ ਬੱਸ ਨੂੰ ਯੂਜ਼ ਕਰਦੇ ਹਾਂ ਤਾਂ ਉੱਥੇ ਜਿਹੜੀਆਂ ਆਪਾਂ ਨੂੰ ਚੁਣੌਤੀਆਂ ਫੇਸ ਕਰਨੀਆਂ ਪੈਂਦੀਆਂ ਨੇ ਸਭ ਤੋਂ ਪਹਿਲਾਂ ਚੁਣੌਤੀ ਹੁੰਦੀ ਹੈ ਕਿ ਬੱਸ ਦੇ ਵਿੱਚ ਭੀੜ ਜ਼ਿਆਦੇ ਹੁੰਦੀ ਆ ਉੱਥੇ ਪ੍ਰੋਪਰ ਇੱਕ ਬੈਠਣ ਦੀ ਫੈਸਿਲਿਟੀ ਨਹੀਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਜਿਹੜੀਆਂ ਬੱਸਾਂ ਨੇ ਉਹ ਕਿਸੇ ਸਟੋਪ ਦੇ ਉੱਪਰ ਰੁਕਦੀਆਂ ਨੇ ਕਿਸੇ ਸਟੋਪ ਦੇ ਉੱਪਰ ਨਹੀਂ ਰੁਕਦੀਆਂ ਅਤੇ ਉਹਦੇ ਕਰਕੇ ਜਿਹੜੇ ਲੋਕਾਂ ਨੂੰ ਕਾਫੀ ਸਾਰੀ ਦਿੱਕਤ ਆਉਂਦੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਬੱਸਾਂ ਦਾ ਕੀ ਹੁੰਦਾ ਕਿ ਟਾਈਮ ਫਿਕਸਡ ਹੁੰਦਾ ਏ ਅਤੇ ਜਦੋਂ ਆਪਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਹਾਂ ਪਬਲਿਕ ਟਰਾਂਸਪੋਰਟ ਦੇ ਵਿੱਚ ਜਿਹੜਾ ਟਾਈਮ ਹੈ ਉਹ ਜ਼ਿਆਦਾ ਲੱਗਦਾ ਕਿਉਂਕਿ ਜ਼ਿਆਦਾ ਸਟੋਪ ਹੁੰਦੇ ਨੇ ਉੱਥੇ ਭੀੜ ਜ਼ਿਆਦਾ ਹੁੰਦੀ ਆ ਲੋਕਾਂ ਨੂੰ ਚੜ੍ਹਨ ਲੱਗੇ ਜਾਂ ਉਤਰਨ ਲੱਗੇ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਸੋ ਉੱਥੇ ਕਿ ਹੁੰਦਾ ਜਿਹੜੀ ਟਾਈਮ ਦੀ ਵੇਸਟੇਜ ਵੀ ਹੈ ਉਹ ਜ਼ਿਆਦਾ ਹੁੰਦੀ ਹੈ ਤਾਂ ਇਹ ਚੈਲੇਂਜਿਜ਼ ਆ ਜਿਹੜੇ ਜਾਂ ਆਪਾਂ ਫੇਸ ਕਰਦੇ ਹਾਂ